ਬਾਈ ਅਗਸਤ ਉੱਨੀ ਸੌ ਨੜਿਨਵੇਂ ਗਿਆਰ੍ਹਾਂ ਨਵੰਬਰ ਉੱਨੀ ਸੌ ਪੈਂਹਠ ਕੱਤੀ ਅਕਤੂਬਰ ਦ ਦੋ ਹਜ਼ਾਰ ਬਾਰ੍ਹਾਂ ਇੱਕ ਜਨਵਰੀ ਦੋ ਹਜ਼ਾਰ ਵੀਹ ਪੰਦਰ੍ਹਾਂ ਸਤੰਬਰ ਦੋ ਹਜ਼ਾਰ ਤੇਰ੍ਹਾਂ